ਮੈਂ ਕਿਸੇ ਵੱਡੇ ਮੁਕਾਬਲੇ ਜਾਂ ਪ੍ਰਦਰਸ਼ਨੀ ਵਿੱਚ ਤਾਂ ਕਲਾਕਾਰੀ ਨਹੀਂ ਦਿਖਾਈ ਪਰ ਮੈਂ ਆਪਣੇ ਐਲੀਮੈਂਟਰੀ ਅਤੇ ਇੰਟਰਮੈਡੀਏਟਿਡ ਲੈਵਲਾਂ 'ਤੇ ਬਹੁਤ ਚਿੱਤਰਕਾਰੀ ਕੀਤੀ ਹੈ ਸਾਡੇ ਸਕੂਲ ਵਿੱਚ ਹਮੇਸ਼ਾ ਹੀ ਚਿੱਤਰਕਾਰੀ ਦੇ ਬਹੁਤ ਸਾਰੇ ਮੁਕਾਬਲੇ ਹੁੰਦੇ ਰਹਿੰਦੇ ਸਨ ਅਤੇ ਮੈਂ ਹਮੇਸ਼ਾ ਹੀ ਚਿੱਤਰਕਾਰੀ ਦੇ ਮੁਕਾਬਲੇ ਵਿੱਚ ਹਿੱਸਾ ਲੈਂਦੀ ਸੀ ਮੈਨੇ ਚਿੱਤਰਕਾਰੀ ਕਿਸੇ ਤੋਂ ਚੰਗੀ ਤਰ੍ਹਾਂ ਤਾਂ ਨਹੀਂ ਸਿੱਖੀ ਪਰ ਹਰ ਰੋਜ਼ ਮਿਹਨਤ ਕਰਕੇ ਖੁਦ ਹੀ ਚਿੱਤਰਕਾਰੀ ਨੂੰ ਬਹੁਤ ਵਧੀਆ ਬਣਾਇਆ ਸੀ ਮੈਂ ਸਕੂਲ ਵਿੱਚ ਵੀ ਹੁੰਦੇ ਮੁਕਾਬਲਿਆਂ ਵਿੱਚ ਹਮੇਸ਼ਾ ਪਹਿਲੇ ਜਾਂ ਦੂਜੇ ਸਥਾਨ 'ਤੇ ਆਉਂਦੀ ਸੀ ਇਸ ਤੋਂ ਇਲਾਵਾ ਮੈਨੂੰ ਚਿੱਤਰਕਾਰੀ ਦਾ ਬਹੁਤ ਹੀ ਸ਼ੌਂਕ ਹੈ ਮੈਂ ਘਰ ਵਿੱਚ ਵੀ ਰੋਜ਼ ਕੋਈ ਨਾ ਕੋਈ ਚਿੱਤਰਕਾਰੀ ਕਰਦੀ ਰਹਿੰਦੀ ਹਾਂ ਮੈਨੂੰ ਚਿੱਤਕਾਰ ਦੀਆਂ ਚਿੱਤਰਕਾਰੀਆਂ ਬਹੁਤ ਪਸੰਦ ਹਨ ਮੈਨੇ ਬਹੁਤ ਸਾਰੇ ਪੇਂਟਰਾਂ ਦੀਆਂ ਪੇਂਟਿੰਗਾਂ ਵੀ ਦੇਖੀਆਂ ਹਨ ਇਸ ਤੋਂ ਇਲਾਵਾ ਮੈਨੂੰ ਰੰਗਾਂ ਦੀ ਬਹੁਤ ਸਮਝ ਹੈ ਅਤੇ ਮੈਨੂੰ ਰੰਗ ਬਹੁਤ ਹੀ ਪਸੰਦ ਹਨ ਚਿੱਤਰਕਾਰੀ ਮੈਂ ਕਿਸੇ ਜ਼ਰੂਰਤ ਲਈ ਨਹੀਂ ਬਲਕਿ ਆਪਦੀ ਮਨ ਦੀ ਖੁਸ਼ੀ ਲਈ ਕਰਦੀ ਹਾਂ ਇਸੀ ਲਈ ਹੀ ਮੈਂ ਚਿੱਤਰਕਾਰੀ ਵਿੱਚ ਬਹੁਤ ਅੱਗੇ ਵ ਅੱਗੇ ਵਧਣਾ ਚਾਹੁੰਦੀ ਹਾਂ